ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਬਹੁਤ ਸਾਰੀਆਂ ਹੋਬੀਜ ਨੇ ਜਿਨ੍ਹਾਂ ਦੇ ਵਿੱਚੋਂ ਪੜ੍ਹਨਾ ਇੱਕ ਹੋਬੀ ਹੈ ਅਤੇ ਅੱਜ ਕੱਲ੍ਹ ਜਿਹੜਾ ਹੈਗਾ ਉਹ ਡਿਜ਼ੀਟਲ ਜ਼ਮਾਨਾ ਆ ਇਸ ਕਰਕੇ ਮੈਂ ਔਨਲਾਈਨ ਰੀਡਿੰਗ ਨੂੰ ਹੀ ਹੈਗਾ ਜਿਹੜਾ ਉਹ ਤਰਜ਼ੀਹ ਦਿੰਦਾ ਅਤੇ ਔਨਲਾਈਨ ਜਿਹੜੀ ਰੀਡਿੰਗ ਹੈਗੀ ਉਹਦਾ ਸਭ ਤੋਂ ਵੱਡਾ ਬੈਨੀਫਿਟ ਤਾਂ ਸਾ ਸਾਨੂੰ ਇਹ ਹੈ ਕਿ ਅੱਜ ਕੱਲ੍ਹ ਜਿਹੜੀ ਹੈਗੀ ਉਹ ਸਾਡੇ ਕੋਲ ਅਰਬਨਾਈਜੇਸ਼ਨ ਹੋਣ ਕਰਕੇ ਸ਼ਹਿਰਾਂ ਦੇ ਵਿੱਚ ਰਹਿਣ ਕਰਕੇ ਘਰਾਂ 'ਚ ਥਾਂਵੋਂ ਥਾਂਵਾਂ ਘੱਟ ਨੇ ਅਤੇ ਕਿਤਾਬਾਂ ਰੱਖਣ ਦੇ ਜਦੋਂ ਤੁਸੀਂ ਜ਼ਿਆਦਾ ਪੜ੍ਹਨ ਦਾ ਤੁਹਾਨੂੰ ਸ਼ੌਂਕ ਆ ਤਾਂ ਫਿਰ ਤੁਹਾਨੂੰ ਜ਼ਿਆਦਾ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਰੱਖਣ 'ਚ ਸੰਭਾਲਣ ਦੇ ਵਿੱਚ ਸਮੱਸਿਆ ਆਉਂਦੀ ਹੈ ਤਾਂ ਈਬੁੱਕ ਸ਼ੋਪਿੰਗ ਜਿਹੜੀ ਈਬੁੱਕਸ ਜਿਹੜੀ ਰੀਡਿੰਗ ਹੈਗੀ ਆ ਜਿਹੜੀ ਉਹ ਉਹ ਆਪਣੇ ਆਪ ਦੇ ਵਿੱਚ ਇਸ ਸਮੱਸਿਆ ਦਾ ਤੁਹਾਡਾ ਹੱਲ ਹੁੰਦਾ ਜਿਹਦੇ ਨਾਲ ਕਿ ਤੁਹਾਨੂੰ ਉਹਨੂੰ ਸਟੋਰ ਕਰਨ 'ਚ ਸੰਭਾਲਣ ਦੀ ਸਮੱਸਿਆ ਜਿਹੜੀ ਉਹ ਨਹੀਂ ਆਉਂਦੀ ਇਸ ਵਾਰ ਮੈਂ ਜਿਹੜੀ ਆਪਣੀ ਕਿਤਾਬ ਜਿਹੜੀ ਹੈਗੀ ਆ ਉਹ ਐਮਜ਼ੋਨ ਤੋਂ ਮੰਗਵਾਈ ਸੀਗੀ ਫਰੈੱਡ ਜੇਮਸਨ ਦੀ ਪੋਸਟਮੌਰਟਨਿਜ਼ਮ ਕਲਚਰਲ ਲੋਜਿਕ ਆਫ਼ ਲੇਟ ਕੈਪੀਟਲਿਜਮ ਅਤੇ ਕਿਤਾਬ ਜਿਹੜੀ ਹੈਗੀ ਆ ਉਹ ਵਾਕਈ ਬਹੁਤ ਸੋਹਣੀ ਸੀਗੀ ਉਹਦਾ ਫੋਂਟ ਬਹੁਤ ਅੱਛਾ ਸੀਗਾ ਉਹਦੀ ਪੇਜ਼ ਕੁਆਲਿਟੀ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਅੱਛੀ ਸੀਗੀ ਉਹਦਾ ਪੇਜ਼ ਕਵਰ ਬਹੁਤ ਸੋਹਣਾ ਸੀਗਾ ਅਤੇ ਮੇਰਾ ਬਹੁਤ ਚੰਗਾ ਤਜ਼ਰਬਾ ਜਿਹੜਾ ਰਿਹਾ ਪਹਿਲਾਂ ਨਾਲੋਂ ਵੀ ਜ਼ਿਆਦਾ ਅਤੇ ਮੈਂ ਆਪਣੀ ਜਿਹੜੀ ਇਸ ਲਿ ਪੜ੍ਹਨ ਦੀ ਜਿਹੜੀ ਮੇਰੀ ਹੋਬੀ ਹੈਗੀ ਹੈ ਉਹਨੂੰ ਅੱਗੇ ਜ਼ਾਰੀ ਰੱਖਦਿਆਂ ਹੋਰ ਵੀ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਔਨਲਾਈਨ ਮੰਗਵਾਉਂਦਾ ਰਹਾਂਗਾ ਥੈਂਕ ਯੂ